ਰਸਕਿਨ ਬੋਂਡ ਦੀ ਬੁੱਕ ਹੈ ਰਿਚ ਡੈਡ ਪੂਅਰ ਡੈਡ ਇਸ ਵਿੱਚ ਦੋ ਫੈਮਿਲੀਜ਼ ਨੂੰ ਰੀਪ੍ਰਜੈਂਟ ਕੀਤਾ ਹੋਇਆ ਜਿਸ ਦੇ ਵਿੱਚ ਇੱਕ ਲੜਕਾ ਅੱਪ ਆਪਣੀ ਫ੍ਰੈਂਡ ਔਰ ਆਪਣੇ ਡੈਡ ਦੇ ਵਿੱਚ ਕੰਮਪੈਰੀਜ਼ਨ ਕਰਕੇ ਦੇਖਦਾ ਉਨ੍ਹਾਂ ਦੇ ਲਾਈਫ਼ ਸਟਾਈਲ ਦੇ ਵਿੱਚ ਉਹਨਾਂ ਦੀ ਫਾਈਨੈਂਸ਼ਲ ਕੰਡੀਸ਼ਨ ਵੀ ਕਿੱਦਾਂ ਦੀ ਹੈ ਉਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ ਹੈ ਜਿਹੜਾ ਪੂਅਰ ਬੁਆਏ ਸੀਗਾ ਉਹ ਦੇਖਦਾ ਹੈ ਕਿ ਜਿਹੜਾ ਮੇਰਾ ਫਾਦਰ ਹੈ ਉਹ ਸਾਰਾ ਖ਼ਰਚਾ ਜੋ ਵੀ ਉਹ ਕਮਾ ਰਿਹਾ ਹੈ ਵੋ ਉਹ ਆਪਣੇ ਉੱਤੇ ਹੀ ਆਪਣੀ ਪੂਰੀ ਫੈਮਿਲੀ ਦੇ ਉੱਤੇ ਲਗਾ ਰਿਹਾ ਏ ਜਿਹੜਾ ਰਿਚ ਹੈ ਉਹ ਆਪਣੀ ਫੈਮਿਲੀ 'ਤੇ ਘੱਟ ਧਿਆਨ ਦੇ ਕੇ ਉਹ ਸਾਰਾ ਖ਼ਰਚਾ ਆਪਣੇ ਉੱਤੇ ਕਰ ਰਿਹਾ ਮਤਲਬ ਇਸ ਬੁੱਕ ਨੂੰ ਰੀਡ ਕਰਕੇ ਇਹ ਐਕਸਪੀਰੀਅਸ ਮਿਲਦਾ ਏ ਕਿ ਅੱਜ ਵੀ ਦੁਨੀਆਂ ਦੇ ਵਿੱਚ ਇੱਦਾਂ ਦੇ ਲੋਕ ਹੈਗੇ ਜਿਹੜੇ ਆਪਸੀ ਕੰਮਪੈਰੀਜ਼ਨ ਕਰਕੇ ਜੱਜਮੈਂਟ ਲਗਾ ਕੇ ਆਪਣੇ ਵਿਊਜ਼ ਨੂੰ ਇੱਦਾਂ ਰੀਪ੍ਰਜੈਂਟ ਕਰਦੇ ਹੈ